ਪੰਜਾਬ ਵਿੱਚ ਵਪਾਰਕ ਕਾਨੂੰਨਾਂ ਦੇ ਸੰਚਾਲਨ ਨੂੰ ਸਮਝਣ ਲਈ ਕੁਛ ਮੁੱਖ ਕਾਨੂੰਨਾਂ ਦੀ ਜਾਣਕਾਰੀ ਮੈਂ ਸਭ ਨੂੰ ਦੇਣਾ ਚਾਹੁੰਦੀ ਹਾਂ ਪਹਿਲਾ ਹੈ ਕੰਪਨੀ ਕਾਨੂੰਨ ਪੰਜਾਬ ਵਿੱਚ ਵਪਾਰਕ ਕਾਨੂੰਨਾਂ ਦਾ ਇੱਕ ਮਹੱਤਵਪੂਰਨ ਹਿੱਸਾ ਹਿੱਸਾ ਹੈ ਕੰਪਨੀ ਕਾਨੂੰਨ ਇਸ ਕਾਨੂੰਨ ਦੇ ਤਹਿਤ ਕੰਪਨੀਆਂ ਦੀ ਰਜਿਸਟਰੇਸ਼ਨ ਉਹਨਾਂ ਦੇ ਸੰਚਾਲਨ ਵੱਖ ਵੱਖ ਮਾਮਲਿਆਂ ਦਾ ਨਿਯਾਂ ਨਿਯਮਿਤ ਪ੍ਰਬੰਧ ਕੀਤਾ ਜਾਂਦਾ ਹੈ ਇਸ ਕਾਨੂੰਨ ਦੇ ਤਹਿਤ ਕੰਪਨੀਆਂ ਨੂੰ ਕਈ ਕਿਸਮਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿਵੇਂ ਕਿ ਵਿੱਤੀ ਰਿਪੋਰਟ ਦੀ ਤਿਆਰੀ ਬੋਰਡ ਦੀ ਮੀਟਿੰਗਾਂ ਦਾ ਆਯੋਜਨ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਜੇ ਕੋਈ ਬੰਦਾ ਇਸ ਜੋ ਵੀ ਨਿਯਮ ਦਿੱਤੇ ਹਨ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਨਹੀਂ ਕਰਦਾ ਤਾਂ ਉਸਦੀ ਅੱਗੇ ਪਨਿਸ਼ਮੈਂਟ ਵੀ ਦੱਸੀ ਜਾਂਦੀ ਹੈ ਕਿ ਉਸ ਬੰਦੇ ਨੂੰ ਕਿੰਨੀ ਪਨਿਸ਼ਮੈਂਟ ਦਿੱਤੀ ਜਾਵੇਗੀ ਦੂਜਾ ਹੈ ਨਵਾਂ ਕੰਪਨੀ ਕਾਨੂੰਨ ਕੰਪਨੀ ਕਾਨੂੰਨ ਵਿੱਚ ਸਮੇਂ ਸਮੇਂ 'ਤੇ ਬਦਲਾਅ ਕੀਤੇ ਜਾਂਦੇ ਹਨ ਤਾਂ ਜੋ ਵਪਾਰ ਦੇ ਬਦਲਦੇ ਮਾਹੌਲ ਨੂੰ ਧਿਆਨ ਵਿੱਚ ਰੱਖਿਆ ਜਾ ਸਕੇ ਨਵਾਂ ਕੰਪਨੀ ਕਾਨੂੰਨ ਇਸੇ ਤਰ੍ਹਾਂ ਦਾ ਇੱਕ ਕਦਮ ਹੈ ਜੋ ਨਵੇਂ ਨਿਯਮਾਂ ਅਤੇ ਨਿਯਮਾਂ ਵਾਲਿਆਂ ਨੂੰ ਸ਼ਾਮਿਲ ਕਰਦਾ ਹੈ ਇਹ ਕਾਨੂੰਨ ਵਪਾਰਿਕ ਸੰਭਾਵਨਾਵਾਂ ਨੂੰ ਵਧਾਉਣ ਅਤੇ ਕਾਰੋਬਾਰਾਂ ਨੂੰ ਅਧਿਕ ਸਪਸ਼ਟਤਾ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ ਤੀਜਾ ਹੈ ਪੰਜਾਬ ਟੈਕਸ ਕਾਨੂੰਨ ਪੰਜਾਬ ਵਿੱਚ ਵਪਾਰਕ ਕਾਰਜਾਂ ਨੂੰ ਨਿਯੰਤਰਿਤ ਕਰਨ ਲਈ ਟੈਕਸ ਕਾਨੂੰਨਾਂ ਦਾ ਵੀ ਮਹੱਤਵਪੂਰਨ ਯੋਗਦਾਨ ਹੈ ਇਹ ਕਾਨੂੰਨ ਵਪਾਰਕ ਗਤੀਵਿਧੀਆਂ 'ਤੇ ਲਾਗੂ ਕੀਤੇ ਜਾਣ ਵਾਲੇ ਵੱਖ ਵੱਖ ਪ੍ਰਕਾਰ ਦੇ ਟੈਕਸਾਂ ਦੀ ਪਾਲਣਾ ਲਈ ਹੁੰਦੇ ਹਨ ਇਹਨਾਂ ਵਿੱਚ ਮੁੱਖ ਤੌਰ 'ਤੇ ਵਿਕਰੀ ਕਰ ਪ੍ਰੋਫੈਸ਼ਨਲ ਕਰ ਅਨੁਕੂਲਤ ਕਰ ਵਿਸ਼ੇਸ਼ ਰੂਪਾਂ ਵਿੱਚ ਜ਼ਿਕਰ ਕੀਤਾ ਜਾ ਸਕਦਾ ਹੈ ਫਿਰ ਹੈ ਪੰਜਾਬ ਟੈਕਸ ਕਾਨੂੰਨ ਸੰਸ਼ੋਧਨ ਅਧਿਨਿਯਮ ਪੰਜਾਬ ਵਿੱਚ ਟੈਕਸ ਕਾਨੂੰਨਾਂ ਵਿੱਚ ਸੰਸ਼ੋਧਨ ਦੀ ਲੋੜ ਸਮੇਂ ਸਮੇਂ ਮਹਿਸੂਸ ਕੀਤੀ ਜਾਂਦੀ ਹੈ ਇਹ ਸੰਸ਼ੋਧਨ ਵਪਾਰ ਅਤੇ ਵਪਾਰਕ ਮਾਹੌਲ ਦੇ ਬਦਲਦੇ ਰੁਖ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਂਦੇ ਹਨ ਇਹਨਾਂ ਸੰਸ਼ੋਧਨਾਂ ਦੇ ਮਾਧਿਅਮ ਵਿੱਚ ਵਪਾਰੀਆਂ ਅਤੇ ਕਾਰੋਬਾਰ ਉਹਨਾਂ ਦੇ ਨਵੇਂ ਨਿਯਮ ਅਤੇ ਜ਼ਿੰਮੇਵਾਰੀਆਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ ਫਿਰ ਹੈ ਕਰਤਾਰ ਕਾਨੂੰਨ ਇਹ ਕਾਨੂੰਨ ਵਰਕਰਾਂ ਅਤੇ ਮਾਲਕਾਂ ਦੇ ਹੱਕਾਂ ਅਤੇ ਜ਼ਿੰਮੇਵਾਰੀਆਂ ਨੂੰ ਨਿਯੰਤਰਿਤ ਕਰਦੇ ਹਨ ਇਸ ਕਾਨੂੰਨ ਦੇ ਤਹਿਤ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਮਿਹਤਨ ਤਨਖਾਹਾਂ ਭੱਤੇ ਸੁਰੱਖਿਆ ਪ੍ਰਦਾਨ ਕਰਨੀ ਹੁੰਦੀ ਹੈ ਇਸ ਕਾਨੂੰਨ ਦਾ ਮੁੱਖ ਉਦੇਸ਼ ਕੰਪਨੀਆਂ ਅਤੇ ਉਹਨਾਂ ਦੇ ਕਰਮਚਾਰੀਆਂ ਦੇ ਵਿਚਕਾਰ ਇੱਕ ਸਫਲ ਅਤੇ ਸੁਚਾਰੂ ਸੰਬੰਧ ਬਣਾਉਣਾ ਹੈ ਜੋ ਹਰ ਇੱਕ ਬੰਦੇ ਨੂੰ ਇਹਨਾਂ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ ਆਪਣੇ ਮੁਲਾਜ਼ਮਾਂ ਨੂੰ ਇੱਕ ਨਿਸ਼ਚਿਤ ਤਿਥੀ 'ਤੇ ਤਨਖਾਹ ਦੇਣੀ ਪੈਂਦੀ ਹੈ ਅਤੇ ਜੋ ਵੀ ਉਹਨਾਂ ਨੂੰ ਸੁਵਿਧਾਵਾਂ ਦੇਣ ਦੇਣੀਆਂ ਹੁੰਦੀਆਂ ਹਨ ਉਹ ਸਾਰੀਆਂ ਹੀ ਦੇਣੀਆਂ ਪੈਂਦੀਆਂ ਹਨ ਕਿਰਤ ਕਾਨੂੰਨ ਪੰਜਾਬ ਵਿੱਚ ਵਪਾਰਕ ਕਾਨੂੰਨ ਵਿੱਚ ਕਿਰਤ ਕਾਨੂੰਨ ਦਾ ਵੀ ਇੱਕ ਮਹੱਤਵਪੂਰਨ ਸਥਾਨ ਹੈ ਇਹ ਕਾਨੂੰਨ ਕੰਪਨੀਆਂ ਨੂੰ ਨਿਯਮਤ ਕਰਨ ਲਈ ਬਣਾਇਆ ਗਿਆ ਹੈ ਜੋ ਉਹਨਾਂ ਦੇ ਆਰਥਿਕ ਕਾਰਜਾਂ ਵਿਤੀ ਲੈਣ ਦੇਣ ਨੂੰ ਨਿਯਮਤ ਕਰਦਾ ਹੈ ਇਸ ਕਾਨੂੰਨ ਦੇ ਤਹਿਤ ਕੰਪਨੀਆਂ ਨੂੰ ਆਪਣੇ ਵਿਤੀ ਰਿਕੋਰਡ ਨੂੰ ਸੁਚਾਰੂ ਅਤੇ ਸਪਸ਼ਟ ਰੱਖਣ ਦੀ ਜ਼ਰੂਰਤ ਹੁੰਦੀ ਹੈ